ਮੈਂ ਬਰਿੰਦਰ ਕੁਮਾਰ ਜ਼ਿਲ੍ਹਾ ਪਠਾਨਕੋਟ ਦਾ ਰਹਿਣ ਵਾਲਾ ਹਾਂ ਮੈਂ ਦੱਸਣਾ ਚਾਹੁੰਦਾ ਹਾਂ ਕਿ ਅੱਜ ਕੱਲ ਖੇਤੀਬਾੜੀ ਕਰਨ ਲਈ ਵੱਖ ਵੱਖ ਤਰ੍ਹਾਂ ਦੇ ਸਾਧਨ ਕਾ ਬਾਜ਼ਾਰ ਵਿੱਚ ਆ ਚੁੱਕੇ ਹਨ ਜਿਵੇਂ ਕੰਮਬਾਇਨ ਟਰੈਕਟਰ ਜੇ ਸੀ ਪੀ ਮੈਂ ਦੱਸਣਾ ਚਾਹੁੰਦਾ ਹਾਂ ਕਿ ਪੁਰਾਣੇ ਸਮਿਆਂ ਵਿੱਚ ਲੋਕ ਬਲਦਾਂ ਨਾਲ ਹਲ ਵਾਹੀ ਕਰਦੇ ਸਨ ਜਿਸ ਨਾਲ ਬਹੁਤ ਜ਼ਿਆਦਾ ਟਾਈਮ ਲੱਗਦਾ ਸੀ ਅੱਜ ਕੱਲ ਟਰੈਕਟਰਾਂ ਨੇ ਉਹੀ ਕੰਮ ਨੂੰ ਬਹੁਤ ਸੁਖਾਲਾ ਬਣਾ ਦਿੱਤਾ ਹੈ ਜਿੱਥੇ ਪਹਿਲਾਂ ਬਹੁਤ ਜ਼ਿਆਦਾ ਘੰਟਿਆਂ ਬੱਧੀ ਸਮਾਂ ਲੱਗਦਾ ਸੀ ਉਸੇ ਕੰਮ ਨੂੰ ਹੁਣ ਤੁਸੀਂ ਥੋੜ੍ਹੇ ਹੀ ਸਮੇਂ ਮਿੰਟਾਂ ਵਿੱਚ ਖਤਮ ਕਰ ਸਕਦੇ ਹੋ ਇੱਦਾਂ ਹੀ ਕੰਬਾਈਨ ਦੀ ਗੱਲ ਕਰੀਏ ਤਾਂ ਕੰਬਾਈਨ ਰੋਜ਼ਾਨਾ ਕਿੱਲਿਆਂ ਦੇ ਹਿਸਾਬ ਨਾਲ ਫਸਲ ਕੱਟ ਕੇ ਘਰਾਂ ਵਿੱਚ ਪਹੁੰਚਾ ਦਿੰਦੀ ਹੈ ਪਹਿਲੇ ਸਮੇਂ ਵਿੱਚ ਕੀ ਹੁੰਦਾ ਸੀ ਕਿ ਲੋਕ ਹੱਥਾਂ ਨਾਲ ਫਸਲਾਂ ਦੀ ਕਟਾਈ ਕਰਦੇ ਸਨ ਇਸ ਨਾਲ ਉਹਨਾਂ ਨੂੰ ਬਹੁਤ ਜ਼ਿਆਦਾ ਸਮਾਂ ਲੱਗਦਾ ਸੀ ਅਤੇ ਫਸਲਾਂ ਕਿੰਨੇ ਕਿੰਨੇ ਦਿਨ ਬਾਹਰ ਜਮ ਪੈਲੀਆਂ ਵਿੱਚ ਹੀ ਪਈਆਂ ਰਹਿੰਦੀਆਂ ਸਨ ਇਸ ਨਾਲ ਕੀ ਹੁੰਦਾ ਸੀ ਕਿ ਕਦੇ ਬਾਰਿਸ਼ ਕਾਰਨ ਫਸਲਾਂ ਖਰਾਬ ਵੀ ਹੋ ਜਾਂਦੀਆਂ ਸਨ ਪਰ ਅੱਜ ਕੱਲ ਕੰਬਾਈਨ ਨੇ ਇਸ ਕੰਮ ਨੂੰ ਇੰਨਾ ਸੁਖਾਲਾ ਬਣਾ ਦਿੱਤਾ ਹੈ ਕਿ ਆਪਾਂ ਉਸ ਦੀ ਵਰਤੋਂ ਕਰਕੇ ਉਸ ਨਾਲ ਕਟਾਈ ਕਰਕੇ ਫਸਲਾਂ ਨੂੰ ਜਲਦੀ ਤੋਂ ਜਲਦੀ ਆਪਣੇ ਘਰਾਂ ਜਾਂ ਮੰਡੀਆਂ ਵਿੱਚ ਪਹੁੰਚਾ ਸਕਦੇ ਹਾਂ ਜੇ ਆਪਾਂ ਜੇ ਸੀ ਪੀ ਦੀ ਗੱਲ ਕਰੀਏ ਤਾਂ ਲੋਕਾਂ ਨੂੰ ਪਹਿਲਾਂ ਹੱਥਾਂ ਨਾਲ ਜਾਂ ਕਹੀ ਨਾਲ ਆਪਣੇ ਜ਼ਮੀਨ ਦੇ ਬੰਨ੍ਹਿਆਂ ਨੂੰ ਪੱਧਰਾ ਕਰਨਾ ਪੈਂਦਾ ਸੀ ਜਾਂ ਉਹਨਾਂ 'ਤੇ ਮਿੱਟੀ ਪਾਉਣਾ ਪੈਂਦੀ ਸੀ ਅਤੇ ਉਸ ਲਈ ਬਹੁਤ ਲੋਕਾਂ ਦੀ ਜ਼ਰੂਰਤ ਪੈਂਦੀ ਸੀ ਅਤੇ ਇਹੋ ਕੰਮ ਕੰਬਾਈਨ ਨੇ ਬਹੁਤ ਆਸਾਨੀ ਨਾਲ ਕਰ ਦਿ ਜੇ ਸੀ ਪੀ ਬਹੁਤ ਆਸਾਨੀ ਨਾਲ ਕਰ ਦਿੰਦੀ ਹੈ ਜਿਸ ਨਾਲ ਉਹ ਕੰਮ ਸੁਖਾਲਾ ਹੋ ਜਾਂਦਾ ਹੈ ਅਤੇ ਮਨੁੱਖੀ ਜੀ ਜ਼ਿੰਦਗੀ ਨੂੰ ਬਹੁਤ ਸੌਖਾ ਬਣਾ ਦਿੱਤਾ ਹੈ ਧੰਨਵਾਦ ਜੀ